ਹੈਲੋ ਹਾਂਜੀ ਮੈਮ ਕੌਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੌਣ ਓਕੇ ਜੀ ਅੱਛਾ ਜੀ ਓਕੇ ਜੀ ਹਾਂਜੀ ਮੈ ਹਾਂਜੀ ਮੈਮ ਤੁਸੀਂ ਬਠਿੰਡੇ ਵਿੱਚ ਬਹੁਤ ਸਾਰੀਆਂ ਜਗ੍ਹਾ ਨੇ ਜਿੱਥੇ ਤੁਸੀਂ ਵਿਜਿਟ ਕਰ ਸਕਦੇ ਹੋ ਤੁਹਾਡਾ ਇੱਕ ਦਿਨ ਦਾ ਟਰਿੱਪ ਹੈ ਜਿਹੜਾ ਉਹ ਆਰਾਮ ਨਾਲ ਪੂਰਾ ਵਧੀਆ ਰਹੇਗਾ ਫਸਟ ਆਫ ਓਲ ਤੁਸੀਂ ਮਤਲਬ ਪਹਿਲਾਂ ਤੁਸੀਂ ਜਾ ਸਕਦੇ ਹੋ ਕਿਲ੍ਹਾ ਮੁਬਾਰਕ ਗੁਰਦੁਆਰਾ ਸਾਹਿਬ ਆ ਉੱਥੇ ਤੁਸੀਂ ਜਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਲੇਕ 'ਤੇ ਜਾ ਸਕਦੇ ਆ ਸ਼ਾਮ ਨੂੰ ਆਪਣੀ ਫੈਮਲੀ ਨਾਲ ਉੱਥੇ ਸ਼ਾਮ ਦਾ ਵੀ ਉਹ ਬਹੁਤ ਵਧੀਆ ਹੁੰਦਾ ਉਹ ਦੇਖਣ ਦੇ ਤੁਸੀਂ ਮਤਲਬ ਕਿਸ਼ਤੀਆਂ ਵਗੈਰਾ 'ਚ ਤੁਸੀਂ ਜੋ ਹੈ ਮਤਲਬ ਝੂਟੇ ਵਗੈਰਾ ਲੈ ਸਕਦੇ ਹੋ ਤਾਂ ਉਸ ਤੋਂ ਬਾਅਦ ਜਿੱਦਾਂ ਹੈ ਮਿੱਤਲ ਮੌਲ ਤੁਸੀਂ ਜਾ ਸਕਦੇ ਹੋ ਉੱਥੇ ਤੁਹਾਨੂੰ ਬਹੁਤ ਸਾਰੀਆਂ ਜਿੱਦਾਂ ਤੁਸੀਂ ਕੱਪੜੇ ਵਗੈਰਾ ਲੈਣੇ ਨੇ ਜਾਂ ਕੋਈ ਹੋਰ ਤੁਹਾਡੀਆਂ ਅਸੈਸਰੀ ਨੇ ਤੁਹਾਨੂੰ ਉੱਥੋਂ ਬਹੁਤ ਵਧੀਆ ਰੇਟ 'ਤੇ ਬਹੁਤ ਵਧੀਆ ਕੁਆਲਿਟੀ ਦੀਆਂ ਜੋ ਮਿਲ ਜਾਣਗੀਆਂ ਉਸ ਤੋਂ ਬਾਅਦ ਇੱਥੇ ਇੱਕ ਮਿਲਕ ਪਲਾਂਟ ਆ ਮਿਲਕ ਪਲਾਂਟ ਤੁਸੀਂ ਜਾ ਸਕਦੇ ਹੋ ਹਾਂ ਉਸ ਤੋਂ ਇਲਾਵਾ ਰੋਜ਼ ਗਾਰਡਨ ਹੈ ਚੇਤਕ ਪਾਰਕ ਦਾਦੀ ਪੋਤੀ ਪਾਰਕ ਤੁਸੀਂ ਉੱਥੇ ਵੀ ਵਿਜਿਟ ਕਰ ਸਕਦੇ ਹੋ ਮਤਲਬ ਇਹ ਜਗ੍ਹਾ ਜਦੋਂ ਦੂਰ ਨਹੀਂ ਹੈਗੀਆਂ ਮਤਲਬ ਨੇੜੇ ਨੇੜੇ ਨੇ ਆਸ ਪਾਸ ਤੁਹਾਨੂੰ ਕਈ ਜਗ੍ਹਾ ਮਿਲ ਜਾਣਗੀਆਂ ਤਾਂ ਉਸ ਤੋਂ ਇਲਾਵਾ ਜੇ ਤੁਸੀਂ ਹੋਰ ਵਿਜਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਆ ਦਮਦਮਾ ਸਾਹਿਬ ਤੁਸੀਂ ਉੱਥੇ ਵੀ ਜਾ ਸਕਦੇ ਹੋ ਤਾਂ ਹਾਂ ਬਸ ਇਹ ਹੀ ਕੁਝ ਜਗ੍ਹਾ ਨੇ ਜਿੱਥੇ ਤੁਸੀਂ ਮਤਲਬ ਘੁੰਮ ਫਿਰ ਸਕਦੇ ਹੋ ਅਤੇ ਇੱਕ ਜੂ ਹੈਗੀ ਆ ਛੱਤ ਬੀੜ ਜੋ ਉੱਥੇ ਵੀ ਮਤਲਬ ਪੂਰਾ ਵਧੀਆ ਤੁਸੀਂ ਇੰਜੋਏ ਕਰ ਸਕਦੇ ਆ

ਹਾਂ ਜੇ ਤੁਸੀਂ ਬੱਸ ਵਗੈਰਾ 'ਤੇ ਜਾਣਾ ਚਾਹੁੰਦੇ ਹੋ ਪਰ ਤੁਹਾਨੂੰ ਬਸ ਸਟੈਂਡ ਜਾਣਾ ਪਵੇਗਾ ਤਾਂ ਬੱਸ ਸਟੈਂਡ ਤੋਂ ਮਤਲਬ ਜ਼ਿਆਦਾ ਨਹੀਂ ਮਤਲਬ ਬਸ 'ਤੇ ਜੇ ਤੁਸੀਂ ਜਾਓਗੇ ਤਾਂ ਜ਼ਿਆਦਾ ਕਿਰਾਇਆ ਵਗੈਰਾ ਵੀ ਨਹੀਂ ਆ ਉਹਨਾਂ ਦਾ ਠੀਕ ਹੈ ਮਤਲਬ ਰੇਟ ਵਾਜਿਬ ਨੇ ਤਾਂ ਜੇ ਤੁਸੀਂ ਬਸ ਵਗੈਰਾ 'ਤੇ ਨਹੀਂ ਜਾਣਾ ਚਾਹੁੰਦੇ ਤੁਸੀਂ ਆਟੋ ਵਗੈਰਾ 'ਤੇ ਵੀ ਜਾ ਸਕਦੇ ਹੋ ਤਾਂ ਉਹਦੇ 'ਚ ਵੀ ਹੈ ਜਿਹੜੀ ਮਤਲਬ ਕਿ ਕੋਈ ਦਿੱਕਤ ਨਹੀਂ ਆਊਗੀ ਮਤਲਬ ਉਹਨਾਂ ਦੇ ਰੇਟ ਵੀ ਸਹੀ ਹੈ ਅਤੇ ਤੁਸੀਂ ਬਹੁਤ ਵਧੀਆ ਜਿਹੜਾ ਆਪਣਾ ਇੱਕ ਦਿਨ ਦਾ ਟ੍ਰਿੱਪ ਪੂਰਾ ਕਰ ਸਕਦੇ ਹੋ

ਓਕੇ ਜੀ ਵੈਲਕਮ